ਵੈਸੇ ਤਾਂ ਮੇਰੇ ਵਿੱਚ ਬਹੁਤ ਤਰ੍ਹਾਂ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਹਨ ਜਿਵੇਂ ਕਿ ਹੋਰ ਲੋਕਾਂ ਵਿੱਚ ਹੁੰਦੀਆਂ ਹਨ ਵਟ ਮੇਰਾ ਸਭ ਤੋਂ ਜਿਹਨੂੰ ਕਿ ਮੈਂ ਸ ਸਭ ਤੋਂ ਵੱਡੀ ਸ਼ਕਤੀ ਸਮਝਦਾ ਏਂ ਜਿਵੇਂ ਕਿ ਮੇਰੇ ਵਿੱਚ ਕਈ ਤਰ੍ਹਾਂ ਦੀਆਂ ਸਕਿੱਲ ਹਨ ਜਿਵੇਂ ਕਿ ਕੈਮਰੇ ਦੀ ਸਕਿੱਲ ਜਾਂ ਕੋਈ ਵੀ ਟੈਕਨੀਕਲ ਸਕਿੱਲ ਹੋਵੇ ਜਿਵੇਂ ਕੰਪਿਊਟਰ ਦੀ ਉਹ ਮੈਨੂੰ ਬਹੁਤ ਮੇਰੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ ਮੈਂ ਕਦੇ ਵੀ ਮੈਨੂੰ ਕੋਈ ਵੀ ਕੰਮ ਕਰਨਾ ਹੁੰਦਾ ਹੈ ਤਾਂ ਮੈਂ ਮੈਨੂੰ ਸੋਚਣਾ ਨਹੀਂ ਪੈਂਦਾ ਮੈਂ ਉਹ ਸਕਿੱਲ ਨੂੰ ਯੂਜ਼ ਕਰਕੇ ਉਹ ਕੰਮ ਨੂੰ ਬਹੁਤ ਜ਼ਿਆਦਾ ਅਸਾਨ ਕਰ ਲੈਂਦਾ ਹਨ ਅਤੇ ਮੇਰੀ ਜਿਹੜੀਆਂ ਕਮਜ਼ੋਰੀਆਂ ਹੈ ਜੀ ਜਿਵੇਂ ਕਿ ਮੈਂ ਭਰੋਸਾ ਬਹੁਤ ਜਲਦੀ ਕਰ ਲੈਂਦਾ ਏ ਕਿਸੇ ਵੀ ਅਣਜਾਣ 'ਤੇ ਜੋ ਕਿ ਅੱਜ ਦੇ ਦੌਰ ਵਿੱਚ ਉਹ ਤੁਹਾਡੇ 'ਤੇ ਭਾਰੀ ਬਣ ਸਕਦਾ ਹੈ ਅਤੇ ਉਹ ਮੇਰੀ ਉਹਨੂੰ ਮੈਂ ਅਪਣੀ ਮਤਲਬ ਕਮਜ਼ੋਰੀ ਸਮਝਦਾ ਜੀ